ਬਿਜਨਲ ਬਿਜਨਸ ਲਈ ਤਾਂ ਕਾਰੋਬਾਰੀ ਲਈ ਤਾਂ ਬਹੁਤ ਵਧੀਆ ਤੁਸੀਂ ਕੁਸ਼ਚਨ ਪੁੱਟ ਕੀਤਾ ਕਿ ਜਿਹੜਾ ਬੰਦਾ ਪਹਿਲਾਂ ਪ੍ਰੋਫਿਟ ਕਮਾਉਂਦਾ ਹੁੰਦਾ ਉਹ ਉਹਦਾ ਡਾਊਨ ਜਾਣ ਦੇ ਕੁਛ ਰੀਜਨ ਹੁੰਦੇ ਨੇ ਹਾਂ ਉਹਦੇ ਲਈ ਮੈਂ ਤੁਹਾਨੂੰ ਦੱਸ ਦਿੰਦਾਂ ਕਿ ਮੇਰਾ ਇੱਕ ਫਰੈਂਡ ਸਰਕਲ ਦੇ ਵਿੱਚ ਸੀ ਜਲੰਧਰ ਚੰਗਾ ਕਾਰੋਬਾਰ ਸੀ ਉਹਦਾ ਸਰਵਿਸ ਦਾ ਕੰਮ ਸੀ ਉਹਦਾ ਸਰਵਿਸ ਫਰੈਂਚਾਈਜੀ ਸੀ ਕਿਸੇ ਕੰਪਨੀ ਨਾਲ ਉਹਦਾ ਟਾਈ ਅਪ ਸੀ ਅਤੇ ਬੜਾ ਵਧੀਆ ਪ੍ਰੋਫਿਟ ਕਮਾ ਰਿਹਾ ਸੀ ਕਿ ਉਹਦੇ ਫਾਦਰ ਸਾਹਿਬ ਤੋਂ ਲੈ ਕੇ ਉਸ ਦੇ ਤੱਕ ਪਹੁੰਚਦਿਆਂ ਪਹੁੰਚਦਿਆਂ ਉਹਨੇ ਵੀ ਘੱਟੋ ਘੱਟ ਦਸ ਬਾਰ੍ਹਾਂ ਸਾਲ ਬਿਜਨਸ ਕੀਤਾ ਸੀ ਔਰ ਵਧੀਆ ਬਿਜਨਸਮੈਨ ਸੀ ਵਧੀਆ ਸਰਵਿਸ ਪ੍ਰੋਵਾਈਡਰ ਸੀ ਸਾਡਾ ਮਤਲਬ ਲੋਕਾਂ ਨੂੰ ਬੜੀ ਵਧੀਆ ਸਰਵਿਸ ਦਿੰਦਾ ਸੀ ਇੰਜੀਨੀਅਰ ਵੀ ਬੜੇ ਖੁਸ਼ ਸੀ ਉਸ ਤੋਂ ਅਤੇ ਓਹ ਰੀਜਨ ਕੀ ਹੋਇਆ ਉਹਦੇ ਕੰਮ ਡਾਊਨ ਹੋਣ ਦਾ ਕਿ ਫਰੈਂਡ ਸਰਕਲ ਦੇ ਵਿੱਚ ਉਹਦਾ ਉੱਠਣਾ ਬੈਠਣਾ ਜ਼ਿਆਦਾ ਹੋ ਗਿਆ ਟਾਈਮ ਘੱਟ ਦਿੰਦਾ ਸੀ ਇਸ ਕਰਕੇ ਥੋੜ੍ਹਾ ਜਿਹਾ ਪਹਿਲਾਂ ਮਾਈਨਰ ਲੋਸ 'ਚ ਗਿਆ ਕੁਝ ਕੰਪਨੀਆਂ ਨੂੰ ਕਹਿਣ ਲੱਗ ਪਈਆਂ ਕਿ ਭਾਈ ਆਪਣੀ ਸਿਟਿੰਗ ਦਿਆ ਕਰੋ ਕੰਮ ਨਹੀਂ ਹੋ ਰਿਹਾ ਕੋਈ ਇਗਨੋਰ ਕਰ ਰਹੇ ਜਿਹੜਾ ਤੇਰਾ ਡਾਟਾ ਕਲੋਜ਼ਰ ਹੈ ਉਹ ਕੰਮ ਨਹੀਂ ਕਰ ਰਿਹਾ ਪਰ ਉਸ ਨੇ ਇਹ ਚੀਜ਼ ਨੂੰ ਇਗਨੋਰ ਕੀਤਾ ਸਿਟਿੰਗ ਘੱਟ ਗਈ ਫਿਰ ਅਲਕੋਹਲ ਦੇ ਵਿੱਚ ਲੱਗ ਗਿਆ ਨਸ਼ਾ ਪੱਤੇ ਦੇ ਚੱਕਰ 'ਚ ਪੈ ਗਿਆ ਅਤੇ ਬਸ ਉਹ ਹੌਲੀ ਹੌਲੀ ਮੇਰਾ ਖਿਆਲ ਹੈ ਕਿ ਜਿਹੜਾ ਪੱਚੀ ਤੀਹ ਸਾਲ ਤੋਂ ਉਹਨੇ ਬਿਜ਼ਨਸ ਉਹਦੇ ਫਾਦਰ ਸਾਹਿਬ ਨੇ ਅਤੇ ਉਹਨੇ ਡਵੈਲਪ ਕੀਤਾ ਹੋਇਆ ਸੀ ਉਹ ਕੁਝ ਮਹੀਨਿਆਂ ਵਿੱਚ ਹੀ ਮਤਲਬ ਕਹਿ ਲੋ ਕਿ ਇੱਕ ਡੇਢ ਸਾਲ ਵਿੱਚ ਪੰਦਰ੍ਹਾਂ ਵੀਹ ਮਹੀਨਿਆਂ ਦੇ ਵਿੱਚ ਵਿੱਚ ਹੀ ਉਹ ਡਾਵਾਂ ਡੋਲ ਹੋ ਗਿਆ ਅੱਜ ਉਹ ਕਾਫੀ ਸਿਹਤ ਵੱਲੋਂ ਵੀ ਕਮਜ਼ੋਰ ਹੋ ਗਿਆ ਕਾਰੋਬਾਰ 'ਚ ਤਾਂ ਚਲੋ ਉਹ ਤਾਂ ਇੱਕ ਕਿਸਮ ਦਾ ਠੱਪ ਹੀ ਹੋ ਗਿਆ ਅਤੇ ਲੋਸ ਹੋਣ ਦੇ ਬਸ ਉਹਦੇ ਇਹੀ ਰੀਜ਼ਨ ਛੋਟੇ ਜਿਹੇ ਰੀਜ਼ਨ ਕਿ ਮਾੜੀ ਸੰਗਤ 'ਚ ਪੈ ਗਿਆ ਅਤੇ ਜਿਹਦੀ ਵਜ੍ਹਾ ਕਰਕੇ ਉਹ ਥੋੜ੍ਹਾ ਜਿਹਾ ਡਾਊਨ ਚਲਾ ਗਿਆ